ਜਿਹੜੀ ਦੇਖੀ ਜਾਵੇ ਜਿਹੜੀ ਡਿਜੀਟਲ ਕਲਾ ਇਹ ਵੀ ਤਾਂ ਮਨੁੱਖ ਨੇ ਡਿਜ਼ਾਇਨ ਕਰਕੇ ਪਾਈ ਹੋਈ ਹੈ ਇਸਦਾ ਘੇਰਾ ਸੀਮਤ ਹੀ ਰਹਿ ਜਾਂਦਾ ਹੈ ਇਸ ਵਿੱਚ ਬਸ ਇੱਕ ਸੋਫਟਵੇਅਰ ਅਪਡੇਟ ਕਰ ਦਿੱਤਾ ਜਾਂਦਾ ਹੈ ਕਿ ਵੀ ਇਹਨੇ ਆਹ ਡਿਜ਼ਾਇਨ ਡਿਜ਼ਾਇਨ ਕਰਨਾ ਹੈ ਇਸ ਵਿੱਚ ਆਪਣੇ ਤਰਫੋਂ ਨਹੀਂ ਸੋਚ ਸਕਦਾ ਜਿਹੜੀ ਮਨੁੱਖੀ ਕਲਾ ਇਸ ਦਾ ਘੇਰਾ ਬਹੁਤ ਜ਼ਿਆਦਾ ਵੱਡਾ ਹੈ ਕਿਉਂਕਿ ਆਦਿ ਕਾਲ ਤੋਂ ਦੇਖਦੇ ਹਾਂ ਕਿਵੇਂ ਕੰਧਾਂ ਘੜ ਘੜ ਕੇ ਮਨੁੱਖ ਨੇ ਆਪਣਾ ਕਲਾ ਦਾ ਨਮੂਨਾ ਪੇਸ਼ ਕਰ ਰਿਹਾ ਮਨੁੱਖ ਦੇ ਹੱਥ ਵਿੱਚ ਪੈਰ ਪੈਰ 'ਤੇ ਕਲਾ ਹੈ ਤਾਂ ਜਿਹੜਾ ਡਿਜੀਟਲ ਕਲਾ ਇਹ ਮਨੁੱਖੀ ਕਲਾ ਦੀ ਰੀਸ ਤਾਂ ਨਹੀਂ ਕਰ ਸਕਦੀ ਪਰ ਮਨੁੱਖੀ ਕਲਾ ਨਾਲ ਤੋਂ ਕੰਮ ਤੇਜ਼ ਜ਼ਰੂਰ ਕਰ ਸਕਦੀ ਹੈ ਇਸ ਲਈ ਆਪਾਂ ਦੇਖਿਆ ਜਾਵੇ ਅੱਜ ਦੇ ਟਾਈਮ 'ਚ ਦੋਨਾਂ ਦੀ ਵਰਤੋਂ ਹੋ ਰਹੀ ਹੈ